ਹੈਲੋ ਰੋਇਲ ਰੈਸਟੋਰੈਂਟ ਮੈਂ ਬੀਰਪਾਲ ਪਿੰਡ ਖਿਲਣ ਤੋਂ ਹਾਂ ਮੈਂ ਹਰ ਹੀ ਵਾਰ ਤੁਹਾਡੇ ਹੀ ਰੈਸਟੋਰੈਂਟ ਤੋਂ ਖਾਣਾ ਮੰਗਵਾਉਂਦੀ ਹਾਂ ਤੁਹਾਡੇ ਰੈਸਟੋਰੈਂਟ ਦਾ ਖਾਣਾ ਬਹੁਤ ਹੀ ਵਧੀਆ ਅਤੇ ਟੇਸਟੀ ਹੁੰਦਾ ਹੈ ਜਿਸ ਲਈ ਮੈਂ ਅੱਜ ਵੀ ਇੱਕ ਘੰਟਾ ਪਹਿਲਾਂ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਮੰਗਵਾਇਆ ਸੀ ਖਾਣੇ ਵਿੱਚ ਚਪਾਤੀਆਂ ਦੋ ਸਬਜ਼ੀਆਂ ਸਲਾਦ ਮਿੱਠੇ ਵਿੱਚ ਗੁਲਾਬ ਜਾਮਣ ਮੰਗਵਾਈ ਸੀ ਪਰ ਹੁਣ ਸਾਡੇ ਪਰਿਵਾਰ ਦਾ ਅਚਾਨਕ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸਾਡੇ ਰਿਸ਼ਤੇਦਾਰੀ ਵਿੱਚ ਪਾਰਟੀ ਹੈ ਉਹਨਾਂ ਨੇ ਸਾਨੂੰ ਹੁਣੇ ਕਾਲ ਕੀਤੀ ਸੀ ਸਾਰਾ ਪਰਿਵਾਰ ਉੱਥੇ ਜਾ ਰਿਹਾ ਹੈ ਇਸ ਲਈ ਘਰ ਤਾਂ ਕੋਈ ਨਹੀਂ ਹੋਣਾ ਅਤੇ ਨਾ ਹੀ ਇਸ ਦਾ ਆਰਡਰ ਕੀਤਾ ਖਾਣਾ ਰੱਦ ਕਰਨਾ ਚਾਹੁੰਦੀ ਹਾਂ ਅਤੇ ਜਿਹੜੀ ਪੇਮੈਂਟ ਮੈਂ ਐਡਵਾਂਸ 'ਚ ਕੀਤੀ ਸੀ ਪਲੀਜ਼ ਮੈਨੂੰ ਉਹ ਟ੍ਰਾਂਸਫਰ ਦੁਬਾਰਾ ਕੀਤੀ ਜਾਵੇ ਜਾਂ ਫਿਰ ਜਦੋਂ ਆ ਕੇ ਦੁਬਾਰਾ ਖਾਣਾ ਆਰਡਰ ਕੀਤਾ ਤਾਂ ਉਸ ਵਿੱਚ ਕੱਟ ਲਿਆ ਜਾਵੇ ਧੰਨਵਾਦ